ਸਾਡੇ ਘਰ ਦੀ ਰਸੋਈ ਸਾਡੇ ਘਰ ਦੇ ਅੰਦਰ ਬਣਾਈ ਹੋਈ ਹੈ ਸਾਡੀ ਰਸੋਈ ਬਹੁਤ ਸਾਫ਼ ਸੁਥਰੀ ਅਤੇ ਹਵਾਦਾਰ ਹੈ ਸਾਡੀ ਰਸੋਈ ਵਿੱਚ ਅਸੀਂ ਕੋਕਰੇਚ ਅਤੇ ਚੂਹਿਆਂ ਨੂੰ ਆਉਣ ਤੋਂ ਰੋਕਣ ਲਈ ਸਾਡੇ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਜਾਲੀ ਦੇ ਬਣਾਏ ਹੋਏ ਹੋਏ ਨੇ ਜਿਸ ਨਾਲ ਚੂਹੇ ਅੰਦਰ ਆਉਣ ਤੋਂ ਰੁਕ ਜਾਂਦੇ ਨੇ ਅਤੇ ਸਾਡੇ ਘਰ ਦੀ ਸਾਰੀ ਸੀਵਰੇਜ ਚੰਗੀ ਤਰ੍ਹਾਂ ਬਣਾਈ ਹੋਈ ਹੈ ਜਿਸ ਨਾਲ ਚੂਹਿਆਂ ਦਾ ਅੰਦਰ ਆਉਣਾ ਰੁਕ ਜਾਂਦਾ ਹੈ ਅਤੇ ਅਸੀਂ ਘਰ ਰਸੋਈ ਦੇ ਅੰਦਰ ਅਸੀਂ ਕੋਈ ਵੀ ਖਾਣ ਵਾਲੀ ਵਸਤੂ ਖਿਲਰਨ ਨਹੀਂ ਦਿੰਦੇ ਤਾਂ ਜੋ ਚੂਹੇ ਅੰਦਰ ਨਾ ਆਉਣ ਅਤੇ ਕਾਕਰੋਚ ਵੀ ਰੁਕ ਜਾਣ ਰਸੋਈ ਵਿੱਚ ਅਸੀਂ ਵੱਧ ਤੋਂ ਵੱਧ ਸਫਾਈ ਰੱਖਦੇ ਹਾਂ ਕੋਈ ਵੀ ਚੀਜ਼ ਨਹੀਂ ਖਿਲਰਨ ਦਿੰਦੇ ਇਸ ਨਾਲ ਚੂਹੇ ਰੁਕ ਜਾਂਦੇ ਨੇ ਅਤੇ ਅਸੀਂ ਰਸੋਈ ਦੇ ਵਿੱਚ ਅਸੀਂ ਦਵਾਈ ਵੀ ਕਰ ਦਵਾਈ ਦੀ ਸਪਰੇ ਵੀ ਕਰ ਦਿੰਦੇ ਹਾਂ ਜਿਸ ਨਾਲ ਚੂਹਿਆਂ ਦਾ ਆਉਣਾ ਬਿਲਕੁਲ ਬੰਦ ਹੋ ਜਾਂਦਾ ਹੈ